ਮੇਰਾ ਧਰਮ ਸਿੱਖ ਹੈ ਮੈਂ ਸਿੱਖੀ ਧਰਮ ਨਾਲ ਜੁੜਿਆ ਹੋਇਆ ਹਾਂ ਪਹਿਲਾਂ ਮੈਂ ਬੁਰੀ ਸੰਗਤ ਦੇ ਵਿੱਚ ਪੈ ਕੇ ਵਾਲ ਕਟਵਾਤੇ ਸੀ ਦਾਹੜੀ ਵੀ ਕਟਵਾਤੀ ਸੀ ਪਰ ਜਦੋਂ ਮੈਂ ਫਤਿਹਗੜ੍ਹ ਸਾਹਿਬ ਗਿਆ ਮੈਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਤਾਂ ਮੈਨੂੰ ਇਸ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਜਿਸ ਕਾਰਨ ਮੈਂ ਆਪਣੇ ਆਪ ਨੂੰ ਦੁਬਾਰਾ ਬਦਲਿਆ ਅਤੇ ਆਪਣੀ ਜੜ੍ਹਾਂ ਨਾਲ ਦੁਬਾਰਾ ਜੁੜਿਆ ਅਤੇ ਉਸਦਾ ਅਸਰ ਪ੍ਰਭਾਵ ਇਹ ਹੈ ਕਿ ਮੈਂ ਅੱਜ ਵੀ ਰੋਜ਼ ਸ ਭੱਠਾ ਸਾਹਿਬ ਜਾਂਦਾ ਹਾਂ ਤਾਂ ਕਿ ਮੈਂ ਆਪਣੀਆਂ ਜੜ੍ਹਾਂ ਨਾਲ ਜੁੜਿਆ ਰਹਿ ਸਕਾਂ ਅਤੇ ਉਹਨਾਂ ਦੇ ਦਿੱਤੇ ਮਾਰਗ ਦੇ ਉੱਤੇ ਚੱਲ ਸਕਾਂ ਇਸ ਮਾਰਗ 'ਤੇ ਚ ਚੱਲਣ ਦੀ ਕੋਸ਼ਿਸ਼ ਵਿੱਚ ਮੈਂ ਰੋਜ਼ ਸਵੇਰੇ ਉੱਠ ਕੇ ਪਾਠ ਵੀ ਕਰਦਾ ਹਾਂ